ਇੱਕ ਵਾਰੀ ਦੀ ਜਦੋਂ ਸਾਡੇ ਸਕੂਲ ਦੇ ਵਿੱਚ ਪ੍ਰਿੰਸਪਲ ਮੈਡਮ ਨੂੰ ਅਸੀਂ ਫੇਅਰਵੈੱਲ ਪਾਰਟੀ ਦੇਣੀ ਸੀਗੀ ਤਾਂ ਉਦੋਂ ਸਾਨੂੰ ਕਿਹਾ ਗਿਆ ਸੀਗਾ ਕੀ ਉਹਨਾਂ ਦੀ ਜਿਹੜੀ ਸਪੀਚ ਹੈ ਉਹਨਾਂ ਦੇ ਬਾਰੇ ਜਿਹੜੀਆਂ ਕੁਝ ਸਤਰਾਂ ਲਿਖਣੀਆਂ ਹਨ ਉਹ ਪੰਜਾਬੀ ਵਿੱਚ ਲਿਖਣੀਆਂ ਹਨ ਪਰ ਅਸੀਂ ਉਹ ਇੰਗਲਿਸ਼ ਵਿੱਚ ਲਿਖ ਲਈਆਂ ਸੀਗੀਆਂ ਅਤੇ ਮੈਨੂੰ ਇੰਨਾ ਪੰਜਾਬੀ ਦਾ ਜ਼ਿਆਦਾ ਗਿਆਨ ਨੀ ਸੀਗਾ ਇਸ ਕਰਕੇ ਮੈਂ ਇੰਗਲਿਸ਼ ਦੇ ਵਿੱਚ ਉਹਨਾਂ ਬਾਰੇ ਬਹੁਤ ਸਾਰੀਆਂ ਸਤਰਾਂ ਲਿਖੀਆਂ ਸੀਗੀਆਂ ਅਤੇ ਜਦੋਂ ਸਾਨੂੰ ਸਕੂਲ ਵਾਲਿਆਂ ਨੇ ਕਿਹਾ ਕਿ ਉਹਨੂੰ ਇੰਗਲਿਸ਼ ਨਹੀਂ ਪੰਜਾਬੀ 'ਚ ਕਰਨਾ ਹੈ ਤਾਂ ਉਸ ਟਾਈਮ 'ਤੇ ਮੈਂ ਗੂਗਲ ਦੀ ਹੈਲਪ ਲਿਤੀ ਸੀਗੀ ਉਦੋਂ ਗੂਗਲ ਦੀ ਮਦਦ ਲੈ ਕੇ ਸਾਰੀ ਇੰਗਲਿਸ਼ ਵਾਲ਼ੀ ਜਿਹੜੀ ਸਪੀਚ ਸੀਗੀ ਉਹ ਗੂਗਲ 'ਤੇ ਜਾ ਕੇ ਟਰਾਂਸਲੇਟ ਕੀਤੀ ਸੀਗੀ ਉਹਦਾ ਅਨੁਵਾਦ ਕੀਤਾ ਪੰਜਾਬੀ ਦੇ ਵਿੱਚ ਜਦੋਂ ਉਹਦਾ ਅਨੁਵਾਦ ਕੀਤਾ ਪੰਜਾਬੀ ਦੇ ਵਿੱਚ ਤਾਂ ਉਹ ਸਭ ਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਅਤੇ ਮੈਨੂੰ ਵੀ ਬਹੁਤ ਅੱਛਾ ਲੱਗਿਆ ਕਿ ਇੰਨਾ ਔਖਾ ਕੰਮ ਜਿਹੜਾ ਸੀਗਾ ਉਹ ਮੇਰਾ ਬੜਾ ਹੀ ਸੌਖਾ ਹੋ ਗਿਆ